ਪੰਜਾਬ ਵਿੱਚ ਕਿਸੇ ਵੀ ਘਰ ਦੇ ਵਿੱਚ ਅਗਰ ਕੋਈ ਲੜਾਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਸਟੇਸ਼ਨ ਜਾਇਆ ਜਾਂਦਾ ਉੱਥੇ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਦੋਨਾਂ ਪਾਸਿਆਂ ਦੀ ਗੱਲ ਸਭ ਕੋ ਸਭ ਕੋਰਟ ਦੇ ਵਿੱਚ ਰੱਖੀ ਜਾਂਦੀ ਹੈ ਅਗਰ ਉੱਥੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਸੁਪਰੀਮ ਕੋਰਟ ਭੇਜਿਆ ਜਾਂਦਾ ਸੁਪਰੀਮ ਕੋਰਟ ਸਾਰੀਆਂ ਗੱਲਾਂ ਦਾ ਹੱਲ ਕਰ ਦਿੰਦਾ ਕੋਈ ਵੀ ਮਸਲਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਕੋਈ ਵੀ ਮਸਲਾ ਹੋਵੇ ਸੁਪਰੀਮ ਕੋਰਟ ਦੇ ਵਿੱਚ ਹੱਲ ਕੀਤਾ ਜਾਂਦਾ ਹੈ ਸੁਪਰੀਮ ਕੋਰਟ ਦੇ ਵਿੱਚ ਕ੍ਰਾਈਮ ਕ੍ਰਾਈਮ ਦਾ ਕੁਝ ਹੋਵੇ ਤਾਂ ਉਹ ਸੁਪਰੀਮ ਕੋਰਟ ਦੇ ਵਿੱਚ ਹੱਲ ਕੀਤਾ ਜਾਂਦਾ ਹੈ